ਪਿਛਲੀ ਗਰਮੀ ਵਿੱਚ ਮੈਂ ਧਰਮਸ਼ਾਲਾ ਸ਼ਹਿਰ ਵਿੱਚ ਗਿਆ ਸੀ ਉੱਥੇ ਇੱਕ ਟਰੈਕ ਹੈ ਜਿਸਦਾ ਨਾਮ ਤਰਿਉਂਡ ਹੈ ਤਰਿਉਂਡ ਦੀ ਚੜਾਈ ਕਾਫੀ ਉੱਚੀ ਹੈ ਅਤੇ ਪਹਿਲਾ ਸਾਨੂੰ ਇੱਕ ਪਹਾੜ ਟੱਪ ਕੇ ਰੱਸੀ ਨਾਲ ਉੱਤੇ ਚੜਨਾ ਪੈਂਦਾ ਹੈ ਉੱਤੇ ਚੜਨ ਨਾਲ ਜੋ ਸਾਨੂੰ ਦ੍ਰਿਸ਼ ਮਿਲਦਾ ਹੈ ਉਹ ਬਹੁਤ ਹੀ ਸੁੰਦਰ ਹੁੰਦਾ ਹੈ ਅਤੇ ਸਾਨੂੰ ਉੱਥੇ ਇੱਕ ਰਾਤ ਕੱਟਣੀ ਪੈਂਦੀ ਹੈ ਰਾਤ ਕੱਟਣ ਲਈ ਸਾਨੂੰ ਉੱਥੇ ਟੈਂਟ ਦਿੱਤੇ ਜਾਂਦੇ ਹਨ ਅਸੀਂ ਟੈਂਟ ਵਿੱਚ ਰੁਕਦੇ ਹਨ ਉੱਥੇ ਜੋ ਦ੍ਰਿਸ਼ ਹੁੰਦਾ ਹੈ ਰਾਤ ਦਾ ਸਾਰੇ ਤਾਰੇ ਚੰਦ ਸਭ ਕੁਛ ਬਿਲਕੁਲ ਕਲੀਅਰ ਦਿਖਦਾ ਹੈ ਸਾਨੂੰ ਅਤੇ ਅਸੀਂ ਰਾਤੀਂ ਸਾਨੂੰ ਠੰਡ ਵੀ ਲੱਗਦੀ ਹੈ ਠੰਡ ਨੂੰ ਖਤਮ ਕਰਨ ਲਈ ਉੱਥੇ ਅੱਗ ਬਾਲੀ ਜਾਂਦੀ ਹੈ ਅਤੇ ਅੱਗ ਬਾਲ ਕੇ ਅਸੀਂ ਮਨੋਰੰਜਨ ਕਰਦੇ ਹਨ